ਪੰਜਾਬ ਦੇ ਮੁੱਖ ਮੀਡੀਆ ਅਖ਼ਬਾਰ ਰੇਡੀਓ ਟੈਲੀਵਿਜ਼ਨ ਅਖ਼ਬਾਰ ਜਗਬਾਣੀ ਅਜੀਤ ਪੰਜਾਬੀ ਟ੍ਰਿਬਿਊਨ ਅਖ਼ਬਾਰ 'ਤੇ ਲੋਕ ਖ਼ਬਰਾਂ ਪੜ੍ਹਦੇ ਆ ਸੁਬਹਾ ਸੁਬਹਾ ਖ਼ਬਰਾਂ ਪੜ੍ਹਦੇ ਆ ਅਤੇ ਇੱਧਰ ਉੱਧਰ ਦੀਆਂ ਜਾਣਕਾਰੀ ਹਾਸਿਲ ਕਰਦੇ ਆ ਅਤੇ ਰੇਡੀਓ 'ਤੇ ਆ ਦੂਰਦਰਸ਼ਨ ਚੈਨਲ ਹੁੰਦਾ ਸੀ ਅਤੇ ਉਹ ਇੱਕ ਚੈਨਲ ਹੀ ਹੁੰਦਾ ਸੀ ਅਤੇ ਉਹਦੇ 'ਤੇ ਲੋਕ ਗਾਣੇ ਸੁਣਦੇ ਸੀ ਅਤੇ ਆਪਣਾ ਮਨੋਰੰਜਨ ਕਰਦੇ ਸੀ ਟੀ ਵੀ 'ਤੇ ਨ ਫਿਲਮਾਂ ਚੱਲਦੀਆਂ ਗਾਣੇ ਚੱਲਦੇ ਆ ਚੱਤੇ ਬੱਚੇ ਬੱਚਿਆਂ ਦੇ ਕਈ ਪ੍ਰੋਗਰਾਮ ਚੱਲਦੇ ਆ ਜਿਵੇਂ ਮਿਸਟਰ ਪੰਜਾਬ ਮਿਸ ਪੰਜਾਬਣ ਬੱਚੇ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਆ ਜਾਣਕਾਰੀ ਹਾਸਿਲ ਕਰਦੇ ਆ ਅਤੇ

ਆਪਣਾ ਮਨੋਰੰਜਨ ਕਰਦੇ ਆ ਅਤੇ ਗਾਣੇ ਫਿਲਮਾਂ ਫਿਲਮਾਂ ਵੇਖਦੇ ਆ ਅਤੇ ਗਾਣੇ ਗਾਉਂਦੇ ਆ ਅਤੇ ਆਪਣਾ ਵਧੀਆ ਮਨੋਰੰਜਨ ਕਰਦੇ ਆ ਅਤੇ ਗਾਣੇ ਮੇਰਾ ਸਾਡੇ ਘਰ ਮੇਰਾ ਭਰਾ ਵੀ ਗਾਣੇ ਗਾਉਂਦਾ ਉਹਨੂੰ ਗਾਣੇ ਗਾਉਣਾ ਪਸੰਦ ਆ ਸੁਣਨਾ ਪਸੰਦ ਆ ਅਤੇ ਉਹ ਟੀ ਵੀ ਤੋਂ ਦੇਖ ਕੇ ਗਾਣੇ ਸੁਣਦਾ ਅਤੇ ਗਾਉਂਦਾ